ਪੰਜਾਬ ਵਿੱਚ ਅਲੱਗ ਅਲੱਗ ਧਰਮਾਂ ਦੇ ਲੋਕ ਵੱਸਦੇ ਨੇ ਜ਼ਿਆਦਾਤਰ ਇੱਥੇ ਮਜੋਰਟੀ ਦੇ ਵਿੱਚ ਸਿੱਖ ਨੇ ਉਸ ਤੋਂ ਬਾਅਦ ਹਿੰਦੂ ਨੇ ਉਸ ਤੋਂ ਬਾਅਦ ਮੁਸਲਮਾਨ ਨੇ ਅਤੇ ਫਿਰ ਕੁਛ ਲੋਕ ਈਸਾਈ ਮਤ ਦੇ ਵੀ ਰਹਿੰਦੇ ਨੇ ਇੱਥੇ ਅਤੇ ਸਿੱਖ ਮਤ ਦੇ ਵਿੱਚ ਜੋ ਗੁਰੂ ਨਾਨਕ ਸਾਹਿਬ ਨੇ ਧਰਮ ਦਾ ਜਿਸ ਤਰ੍ਹਾਂ ਪ੍ਰਚਾਰ ਕੀਤਾ ਹੈ ਉਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਗੁਰਬਾਣੀ ਪੜ੍ਹ ਕੇ ਜਪ ਕਰਕੇ ਆਪਣਾ ਵਿਅਕਤੀਗਤ ਨਿੱਜੀ ਸਵੈ ਖੋਜੀ ਸਵੈ ਸਰ ਕਰ ਸਕਦੇ ਹਾਂ ਗੁਰਬਾਣੀ ਦੇ ਉੱਪਰ ਚੱਲ ਕੇ ਇਸ ਤਰ੍ਹਾਂ ਹਿੰਦੂ ਧਰਮ ਦੇ ਵਿੱਚ ਜੋ ਹਿੰਦੂ ਧਰਮ ਦੇ ਸ਼ਾਸਤਰ ਨੇ ਰਮਾਇਣ ਗੀਤਾ ਮਹਾਭਾਰਤ ਜਾਂ ਹੋਰ ਵੀ ਗਰੁੜ ਪੁਰਾਣ ਵਗੈਰਾ ਸਿਮਰਤੀਆਂ ਦੇ ਅਕੋਡਿੰਗ ਅਸੀਂ ਆਪਾਂ ਆਪਣੇ ਹਿੰਦੂ ਮਤ ਦੇ ਅਕੋਡਿੰਗ ਆਪਣਾ ਸ਼ ਨਿੱਜੀ ਵਿਕਾਸ ਸਵੈ ਖੋਜ ਸਵੈ ਸੁਧਾਰ ਕਰ ਸਕਦੇ ਹਾਂ ਇਸ ਤਰ੍ਹਾਂ ਇਸਲਾਮ ਦੇ ਵਿੱਚ ਕੀ ਹੈ ਇਸਲਾਮ ਦੇ ਵਿੱਚ ਕੁਰਾਨ ਸ਼ਰੀਫ

ਜੈਨ ਧਰਮ ਦਾ ਮੰਦਰ ਹੈਗਾ ਇੱਥੇ ਜਿਹੜਾ ਕਾਫੀ ਮਸ਼ਹੂਰ ਹੈ ਉਹ ਇਹ ਤਿੰਨੇ ਹੀ ਧਰਮਾਂ ਦੇ ਇੱਥੇ ਜਿਹੜੇ ਮੇਨ ਅਸਥਾਨ ਹੈਗੇ ਨੇ ਅਤੇ ਬਾਕੀ ਜਿਹੜਾ ਈਸਾਈ ਮਤ ਹੈ ਉਹਦਾ ਕੋਈ ਇੱਥੇ ਫਤਿਹਗੜ੍ਹ ਸਾਹਿਬ ਦੇ ਵਿੱਚ ਕੋਈ ਜ਼ਿਆਦਾ ਨਹੀਂ ਹੈ ਪਰ ਪੰਜਾਬ ਦੇ ਵਿੱਚ ਹੈ ਘੱਟ ਹੈ ਇਹਨਾਂ ਦਾ ਜ਼ੋਰ